ਨੀਤੀ ਆਯੋਗ ਦੇ ਤਹਿਤ ਪੰਜਾਬ ਵਿੱਚ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਪਾਸੋਂ ਕਈ ਸਕੀਮਾਂ ਲਿਆਉਂਦੀਆਂ ਗਈਆਂ ਨੀਤੀਆਂ ਦੇ ਆ ਏ ਏਜੰਟ ਕਈ ਤਰ੍ਹਾਂ ਦੀ ਜਾਣਕਾਰੀ ਸਾਨੂੰ ਸਾਂਝੀ ਕਰਨੀ ਉਹਨਾਂ ਦਾ ਫਰਜ਼ ਹੁੰਦਾ ਪ੍ਰੰਤੂ ਪੰਜਾਬ ਵਿੱਚ ਕੁਝ ਇਹੋ ਜਿਹੇ ਏਜੰਟ ਹਨ ਜਿਹੜੇ ਕਿ ਸਾਡੀ ਖੇਤਰੀ ਭਾਸ਼ਾ ਵਿੱਚ ਪੰਜਾਬੀ ਜੋ ਹੈ ਜੋ ਕਿ ਮਾਂ ਬੋਲੀ ਹੈ ਸਾਡੀ ਉਸ ਵਿੱਚ ਜਿਸ ਵਿੱਚ ਅਸੀਂ ਕੰਫਰਟੇਬਲ ਹੁੰਦੇ ਹਾਂ ਉਸ ਵਿੱਚ ਸਕੀਮਾਂ ਦਾ ਵੇਰਵਾ ਦੇਣ ਲਈ ਰਾਜ਼ੀ ਨਹੀਂ ਹੁੰਦੇ ਆਪਣੇ ਆਪ ਨੂੰ ਬਹੁਤ ਹੀ ਪੜ੍ਹਿਆ ਲਿਖਿਆ ਸਮਝਦੇ ਹਨ ਸਾਡੇ ਪੰਜਾਬ ਦੇ ਦੇਸੀ ਮਜ਼ਦੂਰ ਜੇਕਰ ਉਹਨਾਂ ਕੋਲੋਂ ਸਵਾਲ ਪੁੱਛਦੇ ਹਨ ਤਾਂ ਉਹਨਾਂ ਨੂੰ ਅਨਪੜ੍ਹ ਕਹਿ ਕੇ ਜਾ ਪਿਛੜਿਆ ਹੋਇਆ ਕਹਿ ਕੇ ਗੱਲ ਬਦਲ ਦਿੰਦੇ ਹਨ ਜੋ ਕਿ ਸਹੀ ਨਹੀਂ ਹੈ ਪ੍ਰੰਤੂ ਕਈ ਏਜਟ ਚੰਗੇ ਵੀ ਹਨ ਜੋ ਕਿ ਸਾਰੀ ਜਾਣਕਾਰੀ ਵੇ ਵੇਰਵਾ ਸਾਹਿਤ ਲੋਕਾਂ ਅੱਗੇ ਰੱਖਦੇ ਹਨ ਤਾਂ ਜੋ ਸਹੀ ਫੈਸਲਾ ਕਿਸਾਨਾਂ ਵੱਲੋਂ ਜਾਂ ਲੋਕਾਂ ਵੱਲੋਂ ਪੰਜਾਬ ਦੇ ਵੱਲੋਂ ਲਿਆ ਜਾ ਸਕੇ ਨੀਤੀ ਸਹੀ ਢੰਗ ਨਾਲ ਇੰਪਲੀਮੈਂਟ ਕਰੀ ਜਾ ਸਕੇ ਇਹਨਾਂ ਏਜੰਟਾਂ ਕੋਲ ਕਈ ਪ੍ਰਕਾਰ ਦੀ ਜਾਣਕਾਰੀ ਹੁੰਦੀ ਹੈ ਜੋ ਕਿ ਇਹ ਕਈ ਲੋਕਾਂ ਨੂੰ ਦੱਸਦੇ ਹਨ ਅਤੇ ਕਈਆਂ ਨੂੰ ਨਹੀਂ ਵੀ ਦੱਸਦੇ ਜੇਕਰ ਦੱਸਦੇ ਹਨ ਤਾਂ ਅੰਗਰੇਜ਼ੀ ਵਿੱਚ ਦੱਸਦੇ ਹਨ ਜਿਸ ਨੂੰ ਕਿ ਸਮਝਣ ਯੋਗ ਪੰਜਾਬੀ ਕਈ ਨਹੀਂ ਹੁੰਦੇ ਕਈ ਲੋਕ ਆਪਣੀ ਖੇਤੀ ਭਾ ਖੇਤਰੀ ਭਾਸ਼ਾ ਵਿੱਚ ਹੀ ਕੰਫਰਟੇਬਲ ਫੀਲ ਕਰਦੇ ਹਨ ਅਤੇ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹਨ ਜੋ ਕਿ ਕਮਿਊਨੀਕੇਸ਼ਨ ਬੈਰੀਅਰ ਇਸ ਵਿੱਚ ਕਾਫੀ ਹੱਦ ਤੌਰ 'ਤੇ ਦੇਖਿਆ ਜਾਂਦਾ ਹੈ ਪੰਜਾਬ ਦੇ ਲੋਕ ਤਾਂ ਉੱਦਾਂ ਵੀ ਮਿੱਠੇ ਸੁਭਾਅ ਦੇ ਹਨ ਪ੍ਰੰਤੂ ਕਈ ਏਜਂਟ ਓਹਲਾ ਉਹਨਾਂ ਰੱਖ ਕੇ ਉਹਨਾਂ ਨੂੰ ਇਸ ਨੀਤੀ ਨਾਲ ਹੀ ਜੋੜ ਲੈਂਦੇ ਹਨ ਅਤੇ ਬਾਅਦ ਵਿੱਚ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਵਿਆਜ 'ਤੇ ਵਿਆਜ ਲਗਾਈ ਜਾਂਦੇ ਹਨ ਅਤੇ ਕਿਸ਼ਤਾਂ ਭਰਦੇ ਭਰਦੇ ਬੰਦੇ ਥੱਕ ਜਾਂਦੇ ਹਨ